ਸਰਕਾਰ ਨੇ ਵਾਤਾਵਰਨ ਦੀ ਸੰਭਾਲ ਲਈ ਕਈ ਯੋਜਨਾਵਾਂ ਬਣਾਈਆਂ ਹਨ ਅਤੇ ਅੱਗੇ ਵੀ ਬਣਾ ਰਹੀ ਹੈ ਸਰਕਾਰ ਨੇ ਸਰਕਾਰ ਸਾਨੂੰ ਪੁਸਤਕਾਂ ਟੈਲੀਵਿਜ਼ਨ ਨਿਊਜ਼ ਪੇਪਰ ਬਤ ਬਹੁਤ ਚੀਜ਼ਾਂ ਦੁਆਰਾ ਸਾਨੂੰ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਲਈ ਜਾਗਰੂਕ ਕਰਦੀ ਹੈ ਮੈਂ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਲਈ ਪਾਣੀ ਦੀ ਵ ਪਾਣੀ ਨੂੰ ਪਾਣੀ ਦੀ ਸਾਂਭ ਸੰਭਾਲ ਕਰਦੀ ਹਾਂ ਮੈਂ ਕੂੜਾ ਕਰਕਟ ਡਸਟਬਿਨ 'ਚ ਸੁੱਟਦੀ ਹਾਂ ਅਤੇ ਪੌਦੇ ਲਗਾਉਂਦੀ ਹਾਂ ਮੈਂ ਵਾਤਾਵਰਨ ਦਾ ਪੂਰਾ ਸ ਪੂਰੀ ਤਰ੍ਹਾਂ ਸਾਂਭ ਸੰਭਾਲ ਕਰਦੀ ਹਾਂ